ਮੈਂ ਇੱਕ ਟੇਲਰ ਹਾਂ ਮੈਂ ਕੱਪੜੇ ਸੀਂਦੀ ਹਾਂ ਜਿਸ ਤਰ੍ਹਾਂ ਕਿ ਕੋਈ ਲੇਡੀ ਮੇਰੇ ਕੋਲ ਸੂਟ ਲੈ ਕੇ ਆਉਂਦੀ ਹੈ ਤਾਂ ਮੈਂ ਸਭ ਤੇ ਪਹਿਲਾਂ ਉਸ ਦਾ ਕੱਪੜਾ ਨਾਪਦੀ ਹਾਂ ਮਿਣਦੀ ਹਾਂ ਵੀ ਕੱਲ੍ਹ ਨੂੰ ਕੋਈ ਐ ਨਾ ਕਹਿ ਦੇਵੇ ਵੀ ਮੇਰੇ ਕੋਲ ਮੈਂ ਤਾਂ ਤੁਹਾਨੂੰ ਪੰਜ ਮੀਟਰ ਕੱਪੜਾ ਦਿੱਤਾ ਸੀਗਾ ਇਹ ਤਾਂ ਚਾਰ ਏ ਨਿਕਲਿਆ ਇਸ ਕਰਕੇ ਆਪਾਂ ਪਹਿਲਾਂ ਉਹਨਾਂ ਦਾ ਕੱਪੜਾ ਮਿਣਦੇ ਹਾਂ ਮਿਣ ਕੇ ਆਪਾਂ ਉਹਦੇ ਉੱਪਰ ਨੇਮ ਸਲਿੱਪ ਲਗਾ ਦਿੰਦੇ ਹਾਂ ਵੀ ਆਹ ਫਲਾਣੇ ਬੰਦੇ ਦਾ ਕੱਪੜਾ ਹੈ ਠੀਕ ਹੈ ਉਸ ਤੇ ਬਾਅਦ ਉਹਨੂੰ ਰੱਖ ਦਿੱਤਾ ਰੱਖ ਕੇ ਜਦੋਂ ਆਪਾਂ ਸੀਂਦੇ ਹਾਂ ਤਾਂ ਉਸ ਟਾਈਮ ਆਪਾਂ ਨਾਪ ਪ੍ਰੋਪਰ ਜੋ ਉਸ ਬੰਦੇ ਨੇ ਆਪਾਂ ਨੂੰ ਨਾਪ ਦਿੱਤਾ ਹੈ ਤਾਂ ਆਪਾਂ ਉਹ ਨਾਪ ਲੈ ਕੇ ਆਪਾਂ ਉਹ ਕੱਪੜਾ ਕਟਿੰਗ ਕਰਦੇ ਹਾਂ ਕਟਿੰਗ ਕਰਕੇ ਸੀਂਦੇ ਹਾਂ ਜੇਕਰ ਮੰਨ ਲਓ ਵੀ ਹੁਣ ਉਹ ਕਸਟਮਰ ਹੈ ਜਿਹੜਾ ਉਹ ਕੱਪੜਾ ਪਾ ਕੇ ਦੇਖਦਾ ਹੈ ਜੇ ਤਾਂ ਉਹਨੂੰ ਘੱਟ ਵੱਧ ਲੱਗ ਰਿਹਾ ਹੈ ਕੁਛ ਉਸ ਟਾਈਮ ਸਾਡੇ ਕੋਲ ਆ ਕੇ ਪਾ ਕੇ ਦੇਖਦਾ ਹੈ ਜੇ ਘੱਟ ਵੱਧ ਲੱਗਦਾ ਅਸੀਂ ਕਰ ਦਿੰਦੇ ਹਾਂ ਠੀਕ ਹੈ ਉਸ ਤੇ ਬਾਅਦ ਉਹਨੂੰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਘਰ ਜਾ ਕੇ ਜੇ ਤੁਸੀਂ ਇਹ ਪਾਉਂਗੇ ਤਾਂ ਇਹ ਸਾਡੀ ਜੁੰਮੇਵਾਰੀ ਨਹੀਂ ਹੈ ਜੋ ਪ੍ਰੋਪਰ ਨਾਪ ਤੁਸੀਂ ਹੁਣ ਸਾਨੂੰ ਦੇ ਰਹੇ ਹੈ ਉਹ ਹੀ ਅਸੀਂ ਸਿਲਣਾ ਹੈ ਠੀਕ ਹੈ ਉਸ ਤੇ ਬਾਅਦ ਅਸੀਂ ਸੀਅ ਤਾ ਕੱਪੜਾ ਇੱਥੇ ਹੀ ਪਵਾ ਕੇ ਦੇਖ ਲਿਆ ਉਸ ਤੇ ਬਾਅਦ ਜਦੋਂ ਵੀ ਕਸਟਮਰ ਧੋਂਦਾ ਹੈ ਕੱਪੜਾ ਜ਼ਾਂ ਕੁਛ ਹੈ ਫਿਰ ਵਾਪਿਸ ਲੈ ਕੇ ਆਉਂਦਾ ਹੈ ਵੀ ਹਾਂ ਵੀ ਆਹ ਸਾਡਾ ਸੂਟ ਟਾਈਟ ਹੋ ਗਿਆ ਜੀ ਸ਼ੀਂਕ ਹੋ ਗਿਆ ਜੀ ਤਾਂ ਇਹਦੇ ਵਿੱਚ ਸਾਡੀ ਤਾਂ ਕੋਈ ਗਲਤੀ ਨਹੀਂ ਅਸੀਂ ਤਾਂ ਫਿਰ ਕਸਟਮਰ ਨੂੰ ਇਹ ਹੀ ਕਹਿੰਦੇ ਹਾਂ ਵੀ ਦੇਖੋ ਅਸੀਂ ਤਾਂ ਤੁਹਾਡੇ ਸਾਹਮਣੇ ਕੱਪੜਾ ਮਿਣਿਆ ਵੀ ਹੈ ਸਭ ਕੁਛ ਕਰਿਆ ਹੈ ਠੀਕ ਹੈ ਤੁਹਾਡੀ ਸੀਣ ਤੋਂ ਬਾਅਦ ਫੀਟਿੰਗ ਵੀ ਚੈੱਕ ਕੀਤੀ ਹੈ ਅਤੇ ਹੁਣ ਘਰ ਜਾ ਕੇ ਜੇ ਤੁਹਾਡਾ ਕੱਪੜਾ ਸ਼ੀਂਕ ਹੋ ਗਿਆ ਜ਼ਾਂ ਕੁਛ ਹੋ ਗਿਆ ਤੇ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੈ ਇਹ ਕੱਪੜੇ ਦੀ ਗਲਤੀ ਹੈ ਕੱਪੜਾ ਅੱਜ ਕੱਲ੍ਹ ਕੀ ਪਤਾ ਕਿਹੋ ਜਿਹਾ ਨਿਕਲਦਾ ਨਹੀਂ ਨਿਕਲਦਾ ਠੀਕ ਹੈ ਇਹਦੇ ਵਿੱਚ ਟੇਲਰ ਦਾ ਕੋਈ ਕਸੂਰ ਨਹੀਂ ਹੈ ਜੇ ਤੁਸੀਂ ਸੁਆਣਾ ਹੈ ਤਾਂ ਠੀਕ ਹੈ ਨਹੀਂ ਸੁਆਣਾ ਅਦਰਵਾਈਜ਼ ਆਪਣਾ ਕੱਪੜਾ ਅੱਗੇ ਤੇ ਸਾਨੂੰ ਦੇਣ ਦੀ ਕੋਈ ਲੋੜ ਨਹੀਂ ਹੈ